ਸਿੰਟਰੋਨ ਏ ਐਕਸ ਵੀ ਬਾਏ ਡੀ ਐੱਫ ਛੇ ਸਟੋਕਸ ਮੈਨ ਸਟੈਂਟ ਬਾਈ ਕਰ ਸਕੂਟਰ ਚੇਤਕ ਮਰੂਤੀ ਅੱਠ ਸੋ ਵਰਨਾ ਐਂਡ ਬ੍ਰੀਜ਼ਾ